ਅਸੀਂ ਛਤਰਾਣੇ ਪਿੰਡ ਵਿੱਚ ਰਹਿੰਦੇ ਹਾਂ ਜੋ ਕਿ ਪਟਿਆਲੇ ਜ਼ਿਲ੍ਹੇ ਵਿੱਚ ਪੈਂਦਾ ਹੈ ਇਹ ਹਰਿਆਣੇ ਦੇ ਬਾਰਡਰ ਦੇ ਲਾਗੇ ਪੈ ਜਾਂਦਾ ਹੈ ਜਿਸ ਕਾਰਨ ਇੱਥੇ ਆਵਾਜਾਈ ਦੇ ਸਾਧਨਾਂ ਵਿੱਚ ਬਹੁਤ ਹੀ ਜ਼ਿਆਦਾ ਕਮੀ ਹੈ ਇੱਥੇ ਕੋਈ ਵੀ ਰੇਲ ਲਾਈਨ ਉਪ ਉਪ ਉਪਲਬਧ ਨਹੀਂ ਹੈ ਸਾਨੂੰ ਰੇਲ ਲਾਈਨ ਲੈਣ ਲਈ ਵੀ ਪਟਿਆਲੇ ਜਾਣਾ ਪੈਂਦਾ ਹੈ ਜੋ ਕਿ ਸਾਨੂੰ ਬਹੁਤ ਦੂਰ ਪੈ ਜਾਂਦੀ ਹੈ ਇੱਥੇ ਸਿਰਫ ਕੇਵਲ ਬੱਸਾਂ ਦੀ ਆਵਾਜਾਈ ਹੀ ਹੈ ਜਿਸ ਕਾਰਨ ਸਾਨੂੰ ਬਹੁਤ ਹੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਕਿਸੇ ਵੀ ਰੂਟ ਵਿੱਚ ਭੀੜ ਦੀ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਕਿਉਂਕਿ ਪਟਿਆਲੇ ਤੋਂ ਇੱਥੇ ਆਉਣ ਵਾਲੇ ਰੂ ਰੂਟ ਹੀ ਬਹੁਤ ਘੱਟ ਹਨ ਮੈਂ ਇਹੀ ਚਾਹੁੰਦਾ ਹਾਂ ਕਿ ਪਟਿਆਲੇ ਤੋਂ ਇੱਧਰ ਨੂੰ ਰੇਲ ਗੱਡੀ ਪਾਈ ਜਾਵੇ ਰੇਲ ਗੱਡੀ ਲਾਈਨ ਪਾਈ ਜਾਵੇ ਤਾਂ ਜੋ ਕਿ ਸਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੋਕ ਆਪਣੇ ਸਾਧਨਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ ਪਟਿਆਲੇ ਪੰਚਮੀ ਸਮੇਂ ਬੱਸਾਂ ਵਿੱਚ ਬਹੁਤ ਭੀੜ ਹੁੰਦੀ ਹੈ ਬੱਸਾਂ ਵਿੱਚ ਚੜ੍ਹਨ ਲਈ ਬਹੁਤ ਦਿੱਕਤ ਆਉਂਦੀ ਹੈ ਇੱਥੇ ਲੰਮੇ ਰੂਟ ਵਾਲੀਆਂ ਬੱਸਾਂ ਵਿੱਚ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਨੂੰ ਸਭ ਤੋਂ ਵੱਧ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ